ਯੋਗ ਦੇ ਬਹੁਤ ਸਾਰੇ ਫਾਇਦੇ ਆ ਜਿੱਦਾਂ ਕਿ ਸਾਡਾ ਸਾਡੇ ਦਿਮਾਗ ਵੀ ਸ਼ਾਂਤ ਰਹਿੰਦਾ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਅਸੀਂ ਸਾਰਾ ਦਿਨ ਪੋਜ਼ੀਟਿਵ ਰਹਿੰਦੇ ਹਾਂ ਕੰਮ ਕਰਨ 'ਚ ਵੀ ਸਾਡਾ ਬਹੁਤ ਦਿਲ ਲੱਗਦਾ ਅਗਰ ਅਸੀਂ ਯੋਗ ਸਵੇਰੇ ਸਵੇਰੇ ਕਰਦੇ ਆ ਨਾ ਤਾਂ ਇਸਦੇ ਸਾਨੂੰ ਬਹੁਤ ਜ਼ਿਆਦਾ ਫਾਇਦੇ ਆ ਸਾਰਾ ਦਿਨ ਸਾਡਾ ਕੰਮ 'ਚ ਬਹੁਤ ਦਿਲ ਲੱਗਿਆ ਰਹਿੰਦਾ ਆ ਅਸੀਂ ਕਿਸੇ ਨਾਲ਼ ਮਿਲਦੇ ਹਾਂ ਅੱਛੇ ਤਰੀਕੇ ਨਾਲ਼ ਮਿਲਦੇ ਹਾਂ ਸਾਡਾ ਦਿਮਾਗ ਸ਼ਾਂਤ ਰਹਿੰਦਾ ਸਾਡਾ ਸਰੀਰ ਹੈ ਜੋ ਵੋ ਤੰਦਰੁਸਤ ਰਹਿੰਦਾ ਆ ਅਤੇ ਹੋਰ ਵੀ ਇਹਦੇ ਯੋਗ ਦੇ ਇੰਨੇ ਸਾਰੇ ਫਾਇਦੇ ਆ ਅਗਰ ਅਸੀਂ ਯੋਗ ਕਰਾਂਗੇ ਤਾਂ ਸਾਨੂੰ ਮੈਡੀਸਨ ਖਾਣ ਦੀ ਜ਼ਰੂਰਤ ਨਹੀਂ ਪਵੇਗੀ ਕਿ ਅਸੀਂ ਬਾਰ ਬਾਰ ਮੈਡੀਸਨ ਖਾਣ ਜਾਵਾਂਗੇ ਸ ਸਾਨੂੰ ਇੰਨਾਂ ਕਿ ਹੈ ਕਿ ਯੋਗ ਕਰਨ ਨਾਲ ਅਸੀਂ ਤੰਦਰੁਸਤ ਰਹਾਂਗੇ